ਮੈਨੂੰ ਡਰਾਇੰਗ ਕਰਨ ਵਿੱਚ ਬਹੁਤ ਰੁਚੀ ਹੈ ਕਈ ਵਾਰ ਇਸ ਨੂੰ ਰਚਨਾਤਮਕ ਨਾਲ ਸੰਤੁਲਿਤ ਕਰਦੇ ਮੈਂ ਇਸ ਵਿੱਚ ਸੱਚਾਈ ਦਿਖਾਉਂਦੀ ਹਾਂ ਕਿ ਆਪਣੇ ਦੇਸ਼ ਦੀ ਕੀ ਸੱਚਾਈ ਹੈ ਜਿਵੇਂ ਕਿ ਜਿਸ ਹਿਸਾਬ ਨਾਲ ਮੇਰਾ ਮੂੜ ਹੁੰਦਾ ਹੈ ਉਸ ਹਿਸਾਬ ਨਾਲ ਮੈਂ ਡਰਾਇੰਗ ਕਰਦੀ ਹਾਂ ਜੇ ਮੈਨੂੰ ਵਿਹਲਾ ਟਾਈਮ ਮਿਲਦਾ ਹੈ ਤਾਂ ਉਦੋਂ ਵੀ ਮੈਂ ਡਰਾਇੰਗ ਕਰ ਲੈਂਦੀ ਹਾਂ ਜੇ ਮੇਰਾ ਮੂਡ ਬਹੁਤ ਵਧੀਆ ਹੈ ਤਾਂ ਮੈਂ ਡਰਾਇੰਗ ਬਹੁਤ ਵਧੀਆ ਅਤੇ ਕ੍ਰਿਏਟਿਵ ਕਰਦੀ ਹਾਂ ਜੇ ਮੇਰਾ ਮੂਡ ਸੈਡ ਹੁੰਦਾ ਹੈ ਜਾਂ ਮੈਂ ਉਦਾਸ ਹੁੰਦੀ ਹਾਂ ਤਾਂ ਮੈਂ ਇਸ ਵਿੱਚ ਅੰਧਕਾਰ ਹੀ ਅੰਧਕਾਰ ਬਣਦਾ ਹੈ ਮੇਰੇ ਤੋਂ ਡਰੋਇੰਗ ਮੇਰੇ ਇਮੋਸ਼ਨਸ ਨਾਲ ਜੁੜੀ ਹੈ ਜੇ ਆਪਾਂ ਕਿਸੇ ਵੀ ਬੱਚੇ ਨੂੰ ਡਰਾਇੰਗ ਕਰਨ ਲਈ ਕਹਿ ਦਈਏ ਚਾਰ ਪੰਜ ਬੱਚਿਆਂ ਨੂੰ ਜੇ ਆਪਾਂ ਡਰਾਇੰਗ ਕਰਨ ਲਈ ਕਹਿ ਦਈਏ ਤਾਂ ਕੋਈ ਬੱਚਾ ਕਿਹੜੀ ਡਰੋਇੰਗ ਬਣਾਏਗਾ ਕੋਈ ਬੱਚਾ ਕਿਸ ਤਰ੍ਹਾਂ ਦੀ ਬਣਾਏਗਾ ਜਿਵੇਂ ਵੀ ਬੱਚੇ ਦੇ ਵਿੱਚ ਫਿਲਿੰਗਸ ਹੋਣਗੀਆਂ ਉਹ ਉਸ ਤਰ੍ਹਾਂ ਦੀ ਹੀ ਡਰਾਇੰਗ ਬਣਾਏਗਾ ਉਹ ਕੀ ਕਰੇਗਾ ਉਹ ਆਪਣੇ ਮਨ ਦੇ ਭਾਵ ਉਸ ਡਰਾਇੰਗ ਦੇ ਵਿੱਚ ਪ੍ਰਗਟ ਕਰੇਗਾ ਐਵੇਂ ਹੀ ਮੇਰੀਆਂ ਭਾਵਨਾਵਾਂ ਵੀ ਇਸ ਵਿੱਚ ਸ਼ਾਮਿਲ ਹਨ ਜੇ ਮੇਰੇ ਕੋਲੋਂ ਕੋਈ ਰੰਗਦਾਰ ਜਾਂ ਬਹੁਤ ਹੀ ਕ੍ਰੀਏਟਿਵ ਬਣਦੀ ਹੈ ਤਾਂ ਉਸ ਟਾਈਮ ਮੇਰੇ ਇਮੋਸ਼ਨਸ ਬਹੁਤ ਵਧੀਆ ਹੁੰਦੇ ਹਨ ਜੇ ਮੇਰਾ ਮੂਡ ਓਫ ਹੈ ਜਾਂ ਮੈਂ ਕਿਸੇ ਵੀ ਗੱਲ ਤੋਂ ਉਦਾਸ ਹਾਂ ਤਾਂ ਮੇਰੇ ਕੋਲ ਉਸ ਟਾਈਮ ਅੰਧਕਾਰ ਹੀ ਪੈਦਾ ਹੁੰਦਾ ਹੈ ਡਰਾਇੰਗ ਦੇ ਵਿੱਚ